ਵੇਖਣ ਲਈ ਮੇਰੀਆਂ ਕੁਝ ਮਨ ਪਸੰਦ ਥਾਵਾਂ ਹਨ ਅਨੰਦਪੁਰ ਸਾਹਿਬ ਅਤੇ ਚੰਡੀਗੜ੍ਹ ਅਨੰਦਪੁਰ ਸਾਹਿਬ ਵਿੱਚ ਮੈਨੂੰ ਅਜੂਬਾ ਬਹੁਤ ਜ਼ਿਆਦਾ ਵਧੀਆ ਲੱਗਿਆ ਉੱਥੇ ਬਹੁਤ ਬੜਾ ਅਜੂਬਾ ਹੈ ਅਤੇ ਉੱਥੇ ਬਹੁਤ ਬੜਾ ਗੁਰਦੁਆਰਾ ਵੀ ਹੈ ਜਿੱਥੇ ਬਹੁਤ ਬੀ ਭੀੜ ਰਹਿੰਦੀ ਹੈ ਅਤੇ ਉਹ ਅਤੇ ਉੱਥੇ ਬਹੁਤ ਸਾਫ ਸਥਾ ਸਾਫ ਸੁਥਰਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਔਰ ਗੁਰਦੁਆਰਾ ਚ ਬਹੁਤ ਭੀੜ ਰਹਿੰਦੀ ਹੈ ਉੱਥੇ ਉੱਥੇ ਦੂਸਰੀ ਚੰਗੀਆਂ ਹਨ ਔਰ ਅਨੰਦਪੁਰ ਵਿੱਚ ਔਰ ਚੰਡੀਗੜ੍ਹ ਵਿੱਚ ਸੜਕਾਂ ਬਹੁਤ ਸਾਫ ਸੁਥਰਾ ਹਨ ਅਤੇ ਉੱਥੇ ਰੂਲਸ ਦਾ ਵੀ ਸੜਕਾਂ ਦੇ ਵੀ ਰੂਲਸ ਲੋਕ ਫੋਲੋ ਕਰਦੇ ਹਨ ਅਤੇ ਉੱਥੇ ਬਹੁਤ ਖੂਬਸੂਰਤ ਖੂਬਸੂਰਤ ਪਾਰਕ ਵੀ ਹਨ ਅਤੇ ਉ ਉੱਥੇ ਵੀ ਇੱਕ ਗੁਰਦੁਆਰਾ ਹੈ ਉਹ ਵੀ ਬਹੁਤ ਸੁੰਦਰ ਹੈ ਔਰ ਉੱਥੇ ਵੀ ਸਾਫ ਸੁਥਰਾ ਦੀ ਧਿਆਨ ਰੱਖੇ ਰੱਖਿਆ ਜਾਂਦਾ ਹੈ ਉੱਥੇ ਰੈਸਟੋਰੈਂਟ ਵੀ ਹੈ ਬਹੁਤ ਸਾਰੇ ਰੈਸਟੋਰੈਂਟ ਵੀ ਹਨ ਰੈਸਟੋਰੈਂਟ ਵਿ ਦੇ ਵਿੱਚ ਵੀ ਸਾਫ ਸੁਥਰਾ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਉੱਥੇ ਖਾਣਾ ਵੀ ਵਧੀਆ ਬਣਾਇਆ ਜਾਂਦਾ ਹੈ ਅਤੇ ਉੱਥੇ ਦ ਦਰਿਆ ਵੀ ਹਨ ਸੋਹਣੇ ਸੋਹਣੇ ਪਾਣੀ ਉ ਉੱਪਰੋਂ ਪਾਣੀ ਨੀਚੇ ਗਿਰਦਾ ਹੈ ਉੱਥੇ ਕਿਸ਼ਤੀ ਵੀ ਹਨ ਦਰਿਆ ਦੇ ਅੰਦਰ ਤੋ ਕਿਸ਼ਤੀ ਦੇ ਵਿੱਚ ਬਹੁਤ ਬਹੁਤ ਕਿਸ਼ਤੀ ਦੇ ਵਿੱਚ ਲੋਕ ਬੈਠ ਲੋਕ ਬੈਠ ਕੇ ਅੱਗੇ ਦਰਿਆ 'ਚ ਘੁੰਮਣ ਜਾਂਦੇ ਹਨ